ਮੇਰਾ ਮੇਰੀ ਕਿਤਾਬ ਦਾ ਮਨਪਸੰਦ ਹਵਾਲਾ ਹੈ ਮਿਲਾਂਗੇ ਜ਼ਰੂਰ ਦਾ ਇੱਕ ਕਹਾਵਤ ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ ਨਾ ਵੀ ਮਿਲੀ ਤਾਂ ਮਰ ਕੇ ਤਾਂ ਮਿਲਾਂਗੇ ਵਿਛੜੇ ਅਸੀਂ ਜਿਨ੍ਹਾਂ ਰਾਹਾਂ 'ਤੇ ਜੇ ਮਿਲਣਾ ਹੋਇਆ ਉੱਥੇ ਹੀ ਮਿਲਾਂਗੇ ਆਪਾਂ ਮਿਲ ਬੈਠਾਂਗੇ ਖੁਲ ਦਿਲ ਬੈਠਾਂਗੇ ਤਾਰਿਆਂ ਦੀ ਚਾਨਣੇ ਕੁਝ ਪਲ ਬੈਠਾਗੇ ਫਿਰ ਗੱਲਾਂ ਕਰਾਂਗੇ ਵੱਖ ਹੋਣ ਦੀਆਂ ਕੋਈ ਦੇਖ ਨਾ ਲਵੇ ਥੋੜ੍ਹੇ ਥੋੜ੍ਹੇ ਡਰਾਂਗੇ ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ ਦਿਲਾਂ 'ਚ ਦੂਰੀਆਂ ਕੀ ਸੀ ਮਜ਼ਬੂਰੀਆਂ ਕਮੀਆਂ ਰਹੀਆਂ ਕਿੱਥੇ ਦੱਸ ਪੂਰੀਆਂ ਅੱਖਾਂ 'ਚ ਘੂਰੀਆਂ ਮੱਥੇ ਸੀ ਤਿਉੜੀਆਂ ਬੁੱਲ ਬੁੱਲਾਂ ਕੋਲੋਂ ਮਿਲਿਆ ਨਾ ਮਜ਼ਬੂਰੀਆਂ ਹੱਥ ਛੱਡ ਜ ਦੇ ਗਏ ਦਿਲੋਂ ਕੱਢਦੇ ਗਏ ਇਹ ਅਨੋਖੀਆਂ ਸਾਂਝੀਆਂ ਤਾਂ ਕਰਾਂਗੇ ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ ਨਾ ਮਿਲੇ ਤਾਂ ਮਰਾਂ ਮਰ ਕੇ ਮਿਲਾਂਗੇ ਜ਼ਰੂ ਜ਼ਰੂਰ ਤੁਹਾ ਇਹ ਸੰਬੰਧਿਤ ਲੱਗਦੀ ਹੈ ਕਿਉਂਕਿ ਇਹ ਦੇ ਵਿੱਚ ਦਿਲ ਦੀ ਗੱਲ ਕੀਤੀ ਹੈ